ਸਿਲਾਈ ਦੇ ਲਈ ਆਪਣੀ ਲਵੇ ਸਭ ਤੋਂ ਪਹਿਲਾਂ ਕੱਪੜਾ ਹੋਣਾ ਚਾਹੀਦਾ ਜੀ ਉਸ ਤੋਂ ਬਾਅਦ ਮਸ਼ੀਨਾਂ ਵੀ ਹੋਣੀਆਂ ਚਾਹੀਦੀਆਂ ਨੇਗੀਆਂ ਕਟਿੰਗ ਟੇਬਲ ਹੋਣਾ ਚਾਹੀਦਾ ਜੀ ਕੈਂਚੀ ਇੰਚੀ ਟੇਪ ਚੌਕ ਵਗੈਰਾ ਹੋਣੇ ਚਾਹੀਦੇ ਹਨ ਜਿਹਨਾਂ ਦੇ ਨਾਲ ਆਪਾਂ ਸਿਲਾਈ ਕਰ ਸਕਦੇ ਹਾਂ ਜਿਹਨਾਂ ਦੇ ਬੇਸ 'ਤੇ ਉਸ ਤੋਂ ਬਾਅਦ ਬੁਣਾਈ ਬੁਣਾਈ ਦੇ ਲਈ ਆਪਣੇ ਲਈ ਵੀ ਸਿਲਾਈਆਂ ਹੋਣੀਆਂ ਚਾਹੀਦੀਆਂ ਨੇ ਕਰੋਸ਼ੀਆ ਹੋਣਾ ਚਾਹੀਦਾ ਕਰੋਸ਼ੀਏ ਦੀ ਅਲੱਗ ਬੁਣਾਈ ਹੁੰਦੀ ਹੈ ਜੀ ਸਲਾਈਆਂ ਦੀ ਅਲੱਗ ਬੁਣਾਈ ਹੁੰਦੀ ਜਿਵੇਂ ਸਵੈਟਰ ਕੋਟੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇਗੀਆਂ ਅੱਛਾ ਜਿਹੜੇ ਇਹ ਸਾਧਨ ਸਿਲਾਈ ਮਸ਼ੀਨਾਂ ਹੋ ਗਈਆਂ ਇਹ ਅਲੱਗ ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇਗੀਆਂ ਸਿੰਪਲ ਮਸ਼ੀਨ ਹੋ ਗਈ ਜੀ ਕਢਾਈ ਵਾਲੀ ਮਸ਼ੀਨ ਹੋ ਗਈ ਜੀ ਆਪਣੀ ਇੰਟਰਲੋਕ ਵਾਲੀ ਮਸ਼ੀਨ ਹੋ ਗਈ ਜੀ ਇੰਟਰਲੋਕ ਵਾਲੀ ਮਸ਼ੀਨ ਜਿੱਦਾਂ ਆਪਾਂ ਸਿਲਾਈ ਕਰਨ ਤੋਂ ਬਾਅਦ ਉਹਦੇ ਅੰਦਰਲੇ ਪਾਸੇ ਜੋ ਕੱਪੜਾ ਛੱਡਿਆ ਹੁੰਦਾ ਉਹਦੇ ਵਿੱਚੋਂ ਧਾਗੇ ਵਗੈਰਾ ਨਿਕਲਦੇ ਨੇਗੇ ਉਹਨਾਂ ਨੂੰ ਮਤਲਬ ਕਿ ਫਿਨਿਸ਼ਿੰਗ ਦੇਣ ਲਈ ਵੀ ਧਾਗਾ ਨਾ ਨਿਕਲੇ ਉਸ 'ਤੇ ਇੰਟਰਲੋਕ ਕੀਤੀ ਜਾਂਦੀ ਹੈ ਕਢਾਈ ਵਾਲੀ ਮਸ਼ੀਨ ਅਲੱਗ ਅਲੱਗ ਤਰ੍ਹਾਂ ਦੀਆਂ ਕਢਾਈਆਂ ਕੀਤੀਆਂ ਜਾਂਦੀਆਂ ਨੇਗੀਆਂ ਕਢਾਈਆਂ ਕਰਕੇ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਦਾ ਜਿੱਦਾਂ ਹੁਣ ਜੇਕਰ ਟਰੈਂਡ ਦੇ ਵਿੱਚ ਮੂਰੀਆਂ 'ਤੇ ਕਢਈ ਚੱਲ ਰਹੀ ਹੈਗੀ ਮੂਹਰੀਆਂ 'ਤੇ ਅਲੱਗ ਅਲੱਗ ਤਰ੍ਹਾਂ ਦੀਆਂ ਕਢਾਈਆਂ ਹੁੰਦੀਆਂ ਨੇਗੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਜੀਟੀ ਡਿਜੀਟਲ ਮਸ਼ੀਨਾਂ ਆਉਂਦੀਆਂ ਨੇਗੀਆਂ ਉਹ ਮਸ਼ੀਨਾਂ ਦੀ ਮਦਦ ਨਾਲ ਆਪਾਂ ਬਹੁਤ ਅੱਗੇ ਜਾ ਸਕਦੇ ਆਪਣੇ ਇਨਕਮ ਦਾ ਸਾਧਨ ਬਣ ਸਕਦਾ ਬਾਕੀ ਜਿਹੜੀਆਂ ਇਹ ਸਾਡੇ ਕੋਲ ਮਸ਼ੀਨਾਂ ਨੇਗੀਆਂ ਸਿੰਪਲ ਮਸ਼ੀਨ ਹੋ ਗਈ ਆਪਣੀ ਇੰਟਰਲੋਕ ਵਾਲੀ ਮਸ਼ੀਨ ਹੋਗੀ ਇਹਨਾਂ ਇਹ ਸਾਨੂੰ ਬਹੁਤ ਜ਼ਿਆਦਾ ਮਦਦਗਾਰ ਹੋਏ ਨੇ ਅੱਗੇ ਜਾਣ ਦੇ ਲਈ